ਮੇਰੇ ਕੋਲ ਸਪਲੈਂਡਰ ਮੋਟਰਸਾਈਕਲ ਹੈ ਅਤੇ ਬਹੁਤ ਵਧੀਆ ਚੱਲਦਾ ਹੈ ਮੇਰੇ ਲਈ ਬਹੁਤ ਜ਼ਿਆਦਾ ਵਧੀਆ ਮੋਟਰਸਾਈਕਲ ਹੈ ਇਹ ਅਤੇ ਮੈਂ ਇਹ ਨਾਲ ਜਿੱਥੇ ਮਰਜ਼ੀ ਲਗ ਲੈ ਜਾਵਾਂ ਜ਼ੋਰ ਨਹੀਂ ਮੰਨਦਾ ਹੈਗਾ ਵਧੀਆ ਐਵਰੇਜ ਹੈ ਇਹਦੀ ਅਤੇ ਮੈਂ ਪਹਾੜ 'ਚ ਘੁੰਮਣ ਲਈ ਗਿਆ ਸੀਗਾ ਸ਼ਿਮਲੇ ਸਾਈਡ ਮਨਾਲੀ ਸਾਈਡ ਮਨੀਕਰਨ ਸਾਹਿਬ ਅਤੇ ਇੱਥੇ ਘਾਟੀਆਂ ਪਰ ਵੀ ਬਹੁਤ ਵਧੀਆ ਚੱਲਿਆ ਨਾ ਕੋਈ ਦਿੱਕਤ ਦਿੱਕਤ ਬਾਜ਼ੀ ਆਈ ਹੈ ਨਾ ਚੱਲਣ 'ਚ ਕੋਈ ਪ੍ਰੋਬਲਮ ਆਈ ਹੈ ਨਾ ਗੇਰ ਅੜਦਾ ਸੀਗਾ ਚੜ੍ਹਾਈ ਦੇ ਉੱਪਰ ਬਹੁਤ ਵਧੀਆ ਚੱਲ ਰਿਹਾ ਸੀਗਾ ਅਸੀਂ ਦੋ ਜਣੇ ਬੈਠੇ ਸੀਗੇ ਅਤੇ ਦੋਹਾਂ ਜਣਿਆਂ ਨਾਲ ਵਧੀਆ ਮੋਟਰਸਾਈਕਲ ਚੱਲ ਰਿਹਾ ਸੀਗਾ ਅਤੇ ਆ ਕੇ ਵੀ ਘਰ ਵਧੀਆ ਚੱਲ ਰਿਹਾ ਨਾ ਸਰਵਿਸ ਕਰਵਾਉਣ ਦੀ ਲੋੜ ਪਈ ਜਲਦੀ ਅਤੇ ਸਹੀ ਚੱਲ ਰਿਹਾ ਹੁਣ ਵੀ ਬਹੁਤ ਵਧੀਆ ਚੱਲ ਰਿਹਾ ਮੇਰੇ ਲਈ ਬਹੁਤ ਵਧੀਆ ਮੋਟਰਸਾਈਕਲ ਆ